ਹੈਲੋ

ਹਾਂਜੀ ਤੁਸੀਂ ਕੌਣ ਹੈਲੋ ਅੱਛਾ ਅੱਛਾ ਸਿਮਰਨ ਕਿੱਦਾਂ ਬਸ ਕੁਛ ਨਹੀਂ ਜੀ ਟੀ ਵੀ ਦੇਖ ਰਹੀ ਸੀਗੀ ਤੁਸੀਂ ਦੱਸੋ ਤੁਸੀਂ ਕੀ ਕਰ ਰਹੇ ਸੀ ਅੱਛਾ ਅੱਛਾ ਇਹ ਤਾਂ ਬਹੁਤ ਚੱਲ ਰਿਹਾ ਅੱਜ ਕੱਲ੍ਹ ਟੀ ਵੀ 'ਤੇ ਹੈ ਨਾ ਹਾਂਜੀ ਹਾਂਜੀ ਹਾਂਜੀ ਉਹ ਵੀ ਆਪਣੇ ਇੱਥੋਂ ਹੀ ਨੇ ਇੰਡੀਆ ਤੋਂ ਹੀ ਨੇ ਭਾਰਤੀ ਜੀ ਵੀ ਜਿਹੜੇ ਉਹਨਾਂ ਨੇ ਵੀ ਹੁਣ ਇਹਦੇ 'ਚ ਕੋਮੇਡੀ ਦੇ ਵਿੱਚ ਕਿੰਨੀ ਤਰੱਕੀ ਕਰ ਲਈ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਦਲਜੀਤ ਜੀ ਵੀ ਦੇਖ ਲਓ ਤੁਸੀਂ ਸਿੰਗਿੰਗ ਤੋਂ ਸ਼ੁਰੂ ਹੋਏ ਸੀਗੇ ਅਤੇ ਅੱਜ ਕੱਲ੍ਹ ਮੂਵੀਜ਼ ਦੇ ਵਿੱਚ ਵੀ ਉਹ ਬਹੁਤ ਹਿੱਟ ਜਾ ਰਹੇ ਨੇ ਹਾਂਜੀ ਹਾਂਜੀ ਲੋਕ ਵੀ ਉਹਨਾਂ ਨੂੰ ਦੇਖਣਾ ਬਹੁਤ ਪਸੰਦ ਕਰਦੇ ਨੇ ਅੱਜ ਕੱਲ੍ਹ ਨਾ ਟੀ ਵੀ 'ਤੇ ਸ਼ਰਮਾ ਸ਼ੋਅ ਹੈ ਇਹ ਤਾਂ ਦਿਲ 'ਤੇ ਰਾਜ ਕਰ ਰਹੇ ਨੇ ਹਾਂਜੀ ਹਾਂ ਬਿਲਕੁਲ ਸਹੀ ਗੱਲ ਹੈ ਹਾਂਜੀ ਹਾਂ ਬਹੁਤ ਨਾਮ ਬਣਾਇਆ ਉਹਨੇ ਸਹੀ ਗੱਲ ਹੈ ਜੀ ਭਾਰਤੀ ਦਾ ਵੀ ਇੱਦਾਂ ਹੀ ਹੈ ਜੀ ਉਹਨਾਂ ਨੇ ਵੀ ਆਪਣਾ ਕਪਿਲ ਸ਼ਰਮਾ ਨਾਲ ਹੀ ਬਹੁਤ ਨਾਂ ਬਣਾ ਲਿਆ ਇੱਦਾਂ ਕੋਮੇਡੀ ਦੇ ਵਿੱਚ ਹਾਂਜੀ ਹਾਂ ਚਲੋ ਠੀਕ ਹੈ ਹਾਂਜੀ ਹਾਂ ਹਾਂਜੀ ਹਾਂ ਠੀਕ ਹੈ ਜੀ ਠੀਕ ਹੈ ਓਕੇ ਜੀ ਠੀਕ ਹੈ ਓਕੇ ਬਾਏ